ਹਾਂਜੀ ਇਹ ਗੱਲ ਬਹੁਤ ਸਹੀ ਹੈ ਵੀ ਜਿਹੜਾ ਗਾਇਨ ਹੈ ਉਹ ਕਿਸੇ ਗੁਰੂ ਤੋਂ ਹੀ ਸਿੱਖਿਆ ਜਾ ਸਕਦਾ ਕਿਉਂਕਿ ਪੰਜਾਬੀ ਦੇ ਵਿੱਚ ਕਹਾਵਤ ਹੈ ਸ਼ਾਹ ਬਿਨਾ ਪੱਤ ਨਹੀਂ ਗੁਰੂ ਬਿਨਾ ਗਤ ਨਹੀਂ ਇਸ ਦਾ ਅਰਥ ਇਹ ਹੈ ਵੀ ਜਿਹੜੇ ਗੁਣ ਆਪਾਂ ਨੂੰ ਗੁਰੂ ਦੇ ਸਕਦਾ ਹੈ ਉਹ ਕੋਈ ਹੋਰ ਨਹੀਂ ਦੇ ਸਕਦਾ ਸਿੰਗਿੰਗ ਇੱਕ ਅਜਿਹਾ ਕਲਾ ਹੈ ਆਰਟ ਹੈ ਜਿਹਦੇ ਵਿੱਚ ਮਨੁੱਖ ਨਿਪੁੰਨ ਹੋਊਗਾ ਤਾਂ ਤਾਂ ਹੀ ਉਹ ਆਪਣਾ ਜਿਹੜਾ ਕੀ ਹੈ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੈ ਮੇਰੇ ਗੁਰੂ ਗੋਪਾਲ ਜੀ ਨੇ ਜਿਨ੍ਹਾਂ ਨੇ ਮ ਮੈਨੂੰ ਗਾਉਣਾ ਸਿਖਾਇਆ ਅਤੇ ਉਹਨਾਂ ਨੇ ਪੰਦਰ੍ਹਾਂ ਸਾਲ ਪਹਿਲਾਂ ਉਹ ਗਾਇਨ ਦੇ ਵਿੱਚ ਰਹੇ ਉਹ ਕਾਫੀ ਬੱਚੇ ਨੂੰ ਸਿਖਾ ਰਹੇ ਨੇਗੇ ਅਤੇ ਮੈਂ ਵੀ ਉਹਨਾਂ ਤੋਂ ਹੀ ਸਿੱਖ ਰਿਹਾ ਹਾਂ ਧੰਨਵਾਦ